ਮੈਂ ਸੋਚਦਾ ਹਾਂ ਕਿ ਟੈਕਨੋਲੋਜੀ ਸਾਡੇ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਸਾਡੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਤਰੀਕੇ ਨੂੰ ਬਹੁਤ ਹੱਦ ਤੱਕ ਬਦਲ ਰਹੀ ਹੈ ਸੋਸ਼ਲ ਮੀਡੀਆ ਵੀਡੀਓ ਸ਼ੇਅਰਿੰਗ ਐਪਸ ਅਤੇ ਮੈਸੇਜਿੰਗ ਐਪਸ ਦੇ ਜ਼ਰੀਏ ਅਸੀਂ ਦੁਨੀਆਂ ਭਰ ਵਿੱਚ ਲੋਕਾਂ ਨਾਲ ਆਪਣੇ ਵਿਚਾਰ ਅਤੇ ਭਾਵਾਂ ਨੂੰ ਤੁਰੰਤ ਅਤੇ ਆਸਾਨੀ ਨਾਲ ਸਾਂਝਾ ਕਰ ਸਕਦੇ ਹਾਂ ਇਹ ਸਾਡੀ ਸਾਂਝ ਅਤੇ ਸੰਸਕ੍ਰਿਤੀ ਲਈ ਨਵੇਂ ਦਰਵਾਜੇ ਖੋਲ ਰਹੀ ਹੈ ਇਹ ਸਾਡੇ ਜੀਵਨ ਵਿੱਚ ਨਵੀਨਤਾ ਲਿਆ ਰਹੀ ਹੈ ਪਰ ਇਸ ਨਾਲ ਸਾਡੇ ਉੱਤੇ ਬਹੁਤ ਮਾੜੇ ਪ੍ਰਭਾਵ ਵੀ ਪੈ ਰਹੇ ਹਨ ਅਸੀਂ ਸਾਰਾ ਦਿਨ ਹੀ ਉਹਨਾਂ ਐਪਾਂ ਵਿੱਚ ਹੀ ਖਰਾਬ ਕਰ ਦਿੰਦੇ ਹਾਂ ਅਸੀਂ ਕੋਈ ਕੰਮ ਨਹੀਂ ਕਰਦੇ